ਪੰਜਾਬ ਮੁੱਖ ਤੌਰ 'ਤੇ ਇੱਕ ਖੇਤੀ ਪ੍ਰਧਾਨ ਪ੍ਰਾਂਤ ਹੈ ਇੱਥੇ ਜ਼ਿਆਦਾ ਜਮੀਨ ਬਹੁਤ ਹੀ ਉਪਜਾਊ ਹੈ ਜਿਹਦੇ ਕਰਕੇ ਪੈਦਾਵਾਰ ਜਿਹੜੇ ਜੀਲਡ ਹੈਗੀ ਹੈ ਉਹ ਬਹੁਤ ਵਧੀਆ ਮਿਲਦੀ ਹੈਗੀ ਆ ਅਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈਗੀ ਹੈ ਉਹਦਾ ਸਕੋਪ ਬਹੁਤ ਜ਼ਿਆਦਾ ਹੈ ਅਗਰ ਕੋਈ ਵੀ ਇੰਡਸਟਰੀਲਿਸਟ ਜਾਂ ਕੋਈ ਵੀ ਐਟਰਾਪਨਿਓਰ ਜਿਹੜਾ ਹੈਗਾ ਆ ਉਹ ਇਸ ਇੰਡਸਟਰੀ ਦੇ ਸੈਟਅਪ ਲਈ ਜਾਂਦਾ ਹੈਗਾ ਤਾਂ ਉਹਨੂੰ ਬਹੁਤ ਹੀ ਮੁਨਾਫਾ ਮਿਲੇਗਾ ਉਹਦੇ ਉਹਦੇ ਵਿੱਚ ਮੇਨ ਕੀ ਹੈਗਾ ਕਿਉਕਿ ਇਹ ਐਗਰੀਕਲਚਰ ਲੈਂਡ ਹੈਗੀ ਹੈ ਖੇਤੀਬਾੜੀ ਵਾਲੀ ਜ਼ਮੀਨ ਹੈ ਉਪਜਾਊ ਜ਼ਮੀਨ ਹੈ ਅਲੱਗ ਅਲੱਗ ਤਰੀਕੇ ਦੀਆਂ ਸਬਜ਼ੀਆਂ ਫਰੂਟ ਜਿਹੜੇ ਹੈਗੇ ਨੇ ਇਸ ਏਰੀਏ ਦੇ ਵਿੱਚ ਬਹੁਤ ਹੀ ਵਧੀਆ ਮਿਲ ਜਾਂਦੇ ਹੈਗੇ ਨੇ ਉਹਨਾਂ ਦੀ ਪੈਦਾਵਾਰ ਵੀ ਬਹੁਤ ਵਧੀਆ ਹੁੰਦੀ ਹੈਗੀ ਹੈ ਅਗਰ ਫੂਡ ਪ੍ਰੋਸੈਸਿੰਗ ਯੂਨਿਟ ਲੱਗੇਗਾ ਉਹਨਾਂ ਦੀ ਪ੍ਰੋਸੈਸਿੰਗ ਦੇ ਨਾਲ ਸਿਰਫ਼ ਲੋਕਲ ਹੀ ਨਹੀਂ ਇਹਦਾ ਸਾਰੇ ਸਮਾਨ ਦਾ ਇਹਨਾਂ ਫਲਾਂ ਸਬਜ਼ੀਆਂ ਦਾ ਜਿਹੜਾ ਹੈਗਾ ਐਕਸਪੋਰਟ ਵੀ ਕੀਤਾ ਜਾ ਸਕਦਾ ਹੈਗਾ ਔਰ ਐਕਸਪੋਰਟ ਤੋਂ ਬਾਅਦ ਜਿਹੜਾ ਹੈਗਾ ਇਹਦੇ ਨਾਲ ਲੋਕਲ ਜਿਹੜੀ ਹੈਗੀ ਹੈ ਲੋਕਲ ਪਾਪੂਲੇਸ਼ਨ ਹੈਗੀ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਇਮਪਲੋਇਮੈਂਟ ਦੀ ਓਪੋਰਚਨਿਟੀਜ ਮਿਲਣਗੀਆਂ ਜਿਹੜੇ ਫਾਰਮਰਜ ਹੋਣਗੇ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਲੋਕਲ ਇੰਪੋਲਾਏਮੈਂਟ ਵੀ ਜਨਰੇਟ ਹੋਵੇਗੀ ਔਰ ਜਿਹੜਾ ਇੰਡਸਟੀ ਹੈਗੀ ਆ ਉਹ ਵੀ ਬਹੁਤ ਹੀ ਪ੍ਰਫੁਲਿੱਤ ਹੋਵੇਗੀ ਧੰਨਵਾਦ ਜੀ